ਹੈਲੋ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਆਕਾਲ ਜੀ ਹਾਂਜੀ ਆਪਣੇ ਭਗਤ ਰਾਮ ਜੀ ਬੋਲ ਰਹੇ ਹੋ ਜੀ ਹਾਂ ਹਾਂਜੀ ਹਾਂ ਮੈਂ ਆਪਣਾ ਇੱਕ ਕਮਰਾ ਚਾਹੀਦਾ ਮਕਾਨ ਚਾਹੀਦਾ ਸੀ ਹਾਂਜੀ ਦੋ ਬੈਡਰੂਮ ਦਾ ਜੀ ਹਾਂਜੀ ਡੇਢ਼ ਕੁ ਸੌ ਗੱਜ ਡੇਢ ਕੁ ਸੌ ਗੱਜ 'ਚ ਹੋਵੇ ਜੀ ਹਾਂ ਹਾਂਜੀ ਅਤੇ ਮੈਰਿਡ ਜੀ ਹਾਂ ਜੀ ਜੀ ਜੀਰਕਪੁਰ ਵਾਲੇ ਪਾਸੇ ਜੀ ਹਾਂ ਜੀ

ਜੀ ਜੀ ਜੀ ਜੀ

ਪੰਦਰਾਂ ਕੁ ਲੱਖ ਦੇ ਲਗਭਗ ਪੰਦਰਾਂ ਤੋਂ ਵੀਹ ਦੇ ਵਿਚਾਲੇ ਜੀ

ਨਹੀਂ ਆਪ ਨਹੀਂ ਆਪਣੇ ਨਾਮ ਜੀ ਹਾਂਜੀ ਓਕੇ ਜੀ ਜੀ ਜੀ ਉੱਪਰ ਉੱਪਰ ਜੇ ਉੱਪਰ ਕੋਈ ਕਮਰਾ ਹੋਵੇ ਨਾਲ ਇੱਕ ਤਾਂ ਵਾਹਲਾ ਵਧੀਆ ਹਾਂ ਹਾਂ ਹਾਂ ਜੀ ਜੀ ਚਲੋ ਸ਼ੁਕਰੀਆ ਜੀ ਕੋਈ ਨਾ ਸ਼ੁਕਰੀਆ ਜੀ ਸ਼ੁਕਰੀਆ ਜੀ ਸ਼ੁਕਰੀਆ ਜੀ ਓਕੇ ਜੀ